ਸ਼੍ਰੀ ਮਾਨ ਜੀ ਭਾਰ ਘਟਾਉਣ ਦੇ ਪ੍ਰੋਗਰਾਮ ਵਿੱਚ ਦਾਖਲਾ ਲੈਣ ਬਾਰੇ ਮੈਂ ਵਿਚਾਰ ਕਰ ਰਿਹਾ ਸੀਗਾ ਅਤੇ ਇਸ ਬਾਰੇ ਮੈਂ ਜਾਨਣਾ ਚਾਂਦਾ ਕੀ ਤੁਹਾਡੇ ਸਿਹਤ ਬੀਮੇ ਸਟਾਰ ਹੈਲਥ ਵਲੋਂ ਇਸ ਦੇ ਵਿੱਚ ਕੀ ਕੀ ਕਵਰ ਦਿੱਤਾ ਗਿਆ ਹੈ ਤਾਂ ਜੋ ਮੈਂ ਆਪਣੇ ਭਾਰ ਘਟਾਉਣ ਸੰਬੰਧੀ ਇਸ ਬਾਰੇ ਵਿਚਾਰ ਕਰ ਰਿਹਾਂ ਅਤੇ ਇਸ ਬਾਰੇ ਮੈਂ ਪੂਰੀ ਜਾਣਕਾਰੀ ਹਾਸਲ ਕਰਨਾ ਚਾਂਦਾ ਹਾਂ ਕਿਰਪਾ ਕਰਕੇ ਇਸ ਦੀ ਪੂਰੀ ਲਿਸਟ ਮੇਰੇ ਵਟਸਐਪ 'ਤੇ ਮੈਨੂੰ ਭੇਜੋ ਤਾਂ ਜੋ ਮੈਂ ਇਸ ਬਾਰੇ ਅੱਛੀ ਤਰ੍ਹਾਂ ਵਿਚਾਰ ਕਰਕੇ ਆਪਣਾ ਭਾਰ ਘਟਾ ਸਕਾਂ ਅਤੇ ਮੇਰੀ ਸਿਹਤ ਤੰਦਰੁਸਤ ਰਵੇ